ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਮੈਂ ਅਨੂ ਬੋਲ ਰਹੀ ਹਾਂ ਮੈਨੂੰ ਤੁਹਾਡਾ ਨੰਬਰ ਅਮਨ ਸਰ ਨੇ ਦਿੱਤਾ ਸੀਗਾ ਹਾਂਜੀ ਐਕਚੁਲੀ ਮੈਂ ਨਾ ਲਾਸਟ ਮੰਨਥ ਆਪਣੇ ਚੰਡੀਗੜ੍ਹ ਤੋਂ ਇੱਥੇ ਸ਼ਿਫਟ ਹੋਈ ਹਾਂ ਅਤੇ ਹੁਣ ਛੁੱਟੀਆਂ ਜਿੱਦਾਂ ਆ ਰਹੀਆਂ ਅਤੇ ਮੈਂ ਆਪਣੇ ਬੱਚਿਆਂ ਨੂੰ ਘੁੰਮਾਉਣ ਲੈ ਕੇ ਜਾਣਾ ਹੈਗਾ ਬਟ ਮੈਨੂੰ ਮੈਨੂੰ ਇੱਥੇ ਦੇ ਕੁਝ ਹਿਸਟੋਰੀਕਲ ਪਲੇਸਿਸ ਬਾਰੇ ਪਤਾ ਨਹੀਂ ਆ ਕੈਨ ਯੂ ਪਲੀਜ ਇਨਫੋਮ ਟੂ ਮੀ

ਓਕੇ ਓਕੇ ਓਕੇ ਠੀਕ ਹੈ ਮੈਮ ਜੀ ਮੈਮ ਹਮ ਜੀ ਮੈਮ ਓਕੇ ਠੀਕ ਹੈ ਮੈਮ ਓਕੇ ਮੈਮ ਓਕੇ ਓਕੇ ਨੀਅਰ ਅਬਾਊਟ ਨੀਅਰ ਅਬਾਊਟ ਨਵਾਂ ਨਵਾਂਸ਼ਹਿਰ ਦੇ ਨੀਅਰ ਅਬਾਊਟ ਜੇ ਜਾਣਾ ਹੋਵੇ ਠੀਕੇ ਹੈ ਮੈਮ ਠੀਕ ਹੈ ਮੈਮ ਥੈਂਕ ਯੂ ਮੈਮ ਥੈਂਕ ਯੂ ਸੋ ਮਚ